ਖੇਤਾਂ ਜਾਂ ਘਰ ਵਿੱਚ ਕੰਮ ਕਰਦੇ ਸਮੇਂ ਤੁਸੀਂ ਆਪਣਾ ਮਨੋਰੰਜਨ ਕਿਵੇਂ ਕਰਦੇ ਹੋ ਕੀ ਲੋਕ ਕੰਮ ਕਰਦੇ ਆ ਲੋਕ ਗੀਤ ਗਾਉਂਦੇ ਹਨ ਆ ਖੇਤਾਂ ਦੇ ਵਿੱਚ ਜਾਂਦੇ ਅਸੀਂ ਖੇਤਾਂ ਦੇ ਵਿੱਚ ਬ ਬਰਸੀਨ ਵੱਢਣ ਜਾਂਦੇ ਹਾਂ ਬਰਸੀਨ ਦੇ ਵਿੱਚ ਆਪਾਂ ਜ ਬ ਬੀਨ ਵੱਢਣ ਜਾਂਦੇ ਹਾਂ ਤਾਂ ਉਸਦੇ ਆਪਣਾ ਟਰੈਕਟਰ ਨਾਲ ਰੱਖਿਆ ਵਿਆ ਟਰੈਕਟਰ ਦੇ ਉੱਪਰ ਆਪਣਾ ਇਹ ਸਪੀ ਸਪੀਕਰ ਲਾ ਕੇ ਆਪਣਾ ਨਾਲੇ ਮਨੋਰੰਜਨ ਆਪਣਾ ਉਹ ਕਰੀ ਜਾਈਦਾ ਆਪਣਾ ਕੱਖ ਪੱਠੇ ਵ ਵੱਢੀ ਜਾਂਦੇ ਹਾਂ ਅਤੇ ਉਹਤੇ ਬਾਅਦ ਆਪਣਾ ਨਾਲੇ ਕੰਮ ਕਰੀ ਜਾਂਦੇ ਹਾਂ ਅਤੇ ਨਾਲੇ ਗਾਣੇ ਗੁਣੇ ਕਰ ਸੁਣ ਸੁਣੀ ਜਾਈਦੇ ਆ ਅਤੇ ਉਹਦੇ ਬਾਅਦ ਅਸੀਂ ਆਪਣਾ ਐਕਣੇ ਹੀ ਬਸ ਕਿਤੇ ਘਰ ਆ ਕੇ ਘਰ ਦੇ ਵਿੱਚ ਡੰਗਰ ਵੱਛਿਆ ਨੂੰ ਨਲਾਉਣ ਲੱਗ ਗਏ ਅਤੇ ਉਹਦੇ ਵਿੱਚ ਆਪਣਾ ਡੈੱਕ ਡੈੱਕ ਲਾ ਲਈਦਾ ਅਤੇ ਨਾਲੇ ਗਾਣੇ ਸੁਣੀ ਜਾਂਦੇ ਹਾਂ ਆਪਣਾ ਨਾਲੇ ਆਪਣਾ ਕੰਮ ਹੋਈ ਜਾਂਦਾ ਅਤੇ ਨਾਲੇ ਮੰਨੋਰੰਜਨ ਹੋਈ ਜਾਂਦਾ ਹੈ ਅਤੇ ਐਕਣੇ ਹੀ ਆਪਣਾ ਮੰਨੋਰੰਜਨ ਕਰ ਕਰਕੇ ਆਪਣਾ ਟੈ ਟਾਈਮ ਪਾਸ ਕਰ ਲਈਦਾ ਅਤੇ ਨਾਲੇ ਕੰਮ ਹੋਈ ਜਾਂਦਾ ਸੌ ਨਵੇਂ ਨਵੇਂ ਸੌਂਗ ਸੌਂ ਚੱਲਦੇ ਅੱਜ ਕੱਲ੍ਹ ਗਾਣੇ ਚੱਲਦੇ ਆ ਅਤੇ ਉਹ ਸੁਣ ਕੇ ਵਧੀਆ ਆਪਣਾ ਮੰਨੋਰੰਜਨ ਕਰੀ ਜਾਂਦੇ ਹੁੰਦੇ ਹਾਂ ਅਤੇ ਨਾਲੇ ਪੈੱਗ ਸ਼ੈੱਗ ਲਾ ਲਈਦਾ ਅਤੇ ਆਪਣਾ ਫਿਰ ਇੰਜੋਏ ਵੀ ਕਰੀ ਜਾਈਦਾ ਅਤੇ ਨਾਲੇ ਘਰ ਦਾ ਕੰਮ ਵੀ ਹੋ ਜਾਂਦਾ ਹੁੰਦਾ